ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਸੁਣਾਓ ਬਸ ਠੀਕ ਠਾਕ ਹੈ ਹਾਂਜੀ ਸਰ ਅੱਛਾ ਜੀ ਹਾਂਜੀ ਹਾਂਜੀ ਅੱਛਾ ਆਪਣਾ ਪੰਜਾਬ ਦੇ ਦੇਖੋ ਜੀ ਜਲੰਧਰ ਲੁਧਿਆਣਾ ਪਟਿਆਲਾ ਫਿਰੋਜ਼ਪੁਰ ਵੱਡੇ ਸ਼ਹਿਰ ਹੈ ਅੰਮ੍ਰਿਤਸਰ ਉਸ ਤੋਂ ਬਾਅਦ ਵੈਸੇ ਮੈਂ ਵੀ ਅੰਮ੍ਰਿਤਸਰ ਹੀ ਰਹਿੰਦਾ ਹੈਗਾ ਵਾਂ ਹਾਂਜੀ ਇੱਥੇ ਦੇਖੋ ਜੀ ਇੱਥੇ ਕਾਫ਼ੀ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ ਆਪਣਾ ਇੱਥੇ ਦ ਆਪਣਾ ਦਰਬਾਰ ਸਾਹਿਬ ਹੈ ਜਲਿਆਂਵਾਲਾ ਬਾਗ ਹੈ ਅਟਾਰੀ ਬੋਡਰ ਹੈਗਾ ਵਾ ਇੱਥੇ ਲਾਗੇ ਆਪਣਾ ਵਾਹਗਾ ਬੋਡਰ ਜਿਹਨੂੰ ਕਹਿੰਦੇ ਆ ਅਤੇ ਹੋਰ ਦੁਰਗਿਆਣਾ ਮੰਦਿਰ ਹੈਗਾ ਹੈ ਅਤੇ ਆਪਣਾ ਇੱਦਾਂ ਕਰੋ ਤੁਸੀਂ ਜਦੋਂ ਵੀ ਤੁਸੀਂ ਇੱਥੇ ਆਓਗੇ ਆਪਣਾ ਬੇਸ਼ੱਕ ਆਉਣਾ ਮੇਰੇ ਕੋਲ ਮੈਂ ਤੁਹਾਨੂੰ ਨਾਲ ਲੈ ਚੱਲਾਂਗਾ ਆਪਣਾ ਜਿੱਥੇ ਵੀ ਜਾਣਾ ਹੋਏਗਾ ਅਤੇ ਹਾਂਜੀ ਹਾਂ ਇੱਥੇ ਚੁੰਗੀ ਵਾਲੇ ਬਾਜ਼ਾਰ 'ਚ ਆ ਜੀ ਆਪਣਾ ਉੱਥੇ ਆ ਜਾਇਓ ਆਪਣਾ ਤੁਸੀਂ ਇਸ ਤਰ੍ਹਾਂ ਕਰਿਓ ਕਰ ਦਿਓ ਜਦੋਂ ਵੀ ਪਹੁੰਚੋਗੇ ਮੈਂ ਤੁਹਾਨੂੰ ਉੱਥੋਂ ਪਿੱਕ ਕਰ ਲਵਾਂਗਾ ਠੀਕ ਆ ਜੀ ਠੀਕ ਆ ਠੀਕ ਹਾਂਜੀ ਟੂਰਿਸਟ ਹਾਂ ਟੂਰਿਸਟ ਬੱਸਾਂ ਵੀ ਹੈਗੀਆਂ ਨੇ ਉਹ ਵੀ ਚੱਲਦੀਆਂ ਨੇ ਹਾਂਜੀ ਹਾਂ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਤੁਹਾਡਾ ਪੂਰੀ ਹੈਲਪ ਕਰਾਂਗੇ ਜੀ ਓਕੇ ਸਰ ਠੀਕ ਆ ਓ ਠੀਕ ਹੈ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ